ਰੂਪਨਗਰ ਜ਼ਿਲ੍ਹੇ ਵਿੱਚ ਮੌਸਮ ਦੀ ਤਬਦੀਲੀ ਆਉਂਦੀ ਹੀ ਰਹਿੰਦੀ ਹੈ ਜਿਵੇਂ ਕਿ ਰੂਪਨਗਰ ਵਿੱਚ ਜਨਵਰੀ ਤੋਂ ਲੈ ਕੇ ਮਾਰਚ ਅਪ੍ਰੈਲ ਤੱਕ ਠੰਡਕ ਠੰਡ ਬਣੀ ਰਹਿੰਦੀ ਹੈ ਅਤੇ ਇਸ ਵਿੱਚ ਜ ਮਈ ਤੋਂ ਲੈ ਕੇ ਅਗਸਤ ਤੱਕ ਇਹ ਗਰਮੀ ਰਹਿੰਦੀ ਹੈ ਅਤੇ ਉਹ ਤੋਂ ਬਾਅਦ ਬਾਰਿਸ਼ ਸ਼ੁਰੂ ਹੁੰਦੀ ਹੈ ਠੀਕ ਹੈ ਤਿੰਨ ਚਾਰ ਮਹੀਨੇ ਬਾਰਿਸ਼ ਪੈਂਦੀ ਹੈ ਇਸ ਤਰ੍ਹਾਂ ਰੂਪਨਗਰ ਵਿੱਚ ਮੌਸਮ ਤਬਦੀਲ ਹੁੰਦਾ ਰਹਿੰਦਾ ਹੈ ਇੱਕ ਰੋਜ਼ਾਨਾ ਜ਼ਿੰਦਗੀ ਵਿੱਚ ਇੱਕ ਬੰਦੇ ਦੇ ਰਹਿਣ ਵਿਅਕਤੀ ਦੇ ਬਤੀਤ ਕਰਨ ਲਈ ਉਰੇ ਦਾ ਜਲਵਾਯੂ ਬਹੁਤ ਵਧੀਆ ਹੈ